ਮੈਂ ਇੱਕ ਵਾਰ ਦੀ ਗੱਲ ਸੁਣਾਉਂਦਾ ਹਾਂ ਮੈਂ ਕੱਪੜੇ ਦੀ ਦੁਕਾਨ 'ਤੇ ਕੰਮ ਕਰਦਾ ਸੀ ਉੱਥੇ ਮੇਰੇ ਕੋਲੋਂ ਇੱਕ ਪੈਂਟ ਇੱਕ ਕਿਸੇ ਹੋਰ ਥਾਂ 'ਤੇ ਰੱਖ ਹੋ ਗਈ ਸੀ ਜਿਸ ਦਾ ਇਲਜ਼ਾਮ ਮੇਰੇ 'ਤੇ ਲੱਗ ਗਿਆ ਸੀ ਉਹ ਕੱਪੜਾ ਪੰਜ ਛੇ ਦਿਨ ਬਾਅਦ ਮੇਰੇ ਮਾਲਕ ਨੂੰ ਉਸੇ ਜਗ੍ਹਾ ਤੋਂ ਮਿਲ ਗਿਆ ਸੀ ਔਰ ਮਾਲਕ ਨੇ ਉਸਦਾ ਇਲਜ਼ਾਮ ਮੇਰੇ 'ਤੇ ਲਗਾ ਦਿੱਤਾ ਮੈਂ ਆਪਣੇ ਮਾਲਕ ਨੂੰ ਕਿਹਾ ਅਗਰ ਮੇਰੇ ਕੋਲੋਂ ਇਹ ਚੀਜ਼ ਗੁਵਾਚੀ ਹੈ ਤਾਂ ਮੈਂ ਇਸ ਦੇ ਪੈਸੇ ਦੇ ਦਿੰਨਾ ਹਾਂ ਤਾਂ ਕੁੱਝ ਟਾਈਮ ਬਾਅਦ ਉਹ ਚੀਜ਼ ਮਾਲਕ ਨੂੰ ਮਿਲ ਗਈ ਅਤੇ ਮੇਰੇ 'ਤੇ ਇਲਜ਼ਾਮ ਹੱਟ ਗਿਆ